ਮੈਂ ਆਪਣੇ ਆਂਢ ਗੁਆਂਢ ਦੇ ਹਰ ਘਰਾਂ ਬਾਰੇ ਬਹੁਤ ਹੀ ਚੰਗੀ ਤਰ੍ਹਾਂ ਜਾਣਦੀ ਹਾਂ ਬਟ ਮੇਰੇ ਆਂਢ ਗੁਆਂਢ ਦੇ ਵਿੱਚ ਕੋਈ ਵੀ ਇਹ ਜਿਹੀ ਸਟੇਅ ਨਹੀਂ ਹੋਮ ਸਟੇਅ ਨਹੀਂ ਹੈਗੀ ਜਿੱਥੇ ਆ ਕੇ ਲੋਕ ਰਹਿਣ ਬਟ ਮੇਰੇ ਨਾਲ਼ ਦੇ ਸ਼ਹਿਰ ਮੋਹਾਲੀ ਵਿੱਚ ਬਹੁਤ ਹੀ ਜ਼ਿਆਦਾ ਹੋਟਲ ਹਨ ਜਿਵੇਂ ਹੋਟਲ ਐਰੋਬੀਨ ਹੋਟਲ ਫਸਟ ਸਟਾਰ ਜਿੱਥੇ ਆ ਕੇ ਬਾਹਰ ਦੀ ਦੁਨੀਆਂ ਰਹਿ ਕੇ ਸਾਡੇ ਚੰਡੀਗੜ੍ਹ ਜਾਂ ਮੋਹਾਲੀ ਨੂੰ ਐਕਸਪਲੋਰ ਕਰਕੇ ਜਾਂਦੀ ਹੈ ਨਵੀਆਂ ਨਵੀਆਂ ਚੀਜ਼ਾਂ ਦੇਖ ਕੇ ਜਾਂਦੀ ਆ ਜਿਵੇਂ ਵਾਟਰ ਪਾਰਕ ਹੋ ਗਿਆ ਸ਼ਹੀਦੀ ਅਸਥਾਨ ਹੋ ਗਏ ਅਤੇ ਹੋਰ ਵੀ ਬਹੁਤ ਚੀਜ਼ਾਂ ਹਨ ਸਾਡੇ ਇੱਥੇ ਦੇਖਣ ਨੂੰ ਨਵੇਂ ਨਵੇਂ ਰੈਸਟੋਰੈਂਟਾਂ 'ਚ ਐਕਸਪਲੋਰ ਕਰਨ ਨੂੰ ਅਤੇ ਉਹ ਕਰਕੇ ਲੋਕ ਆ ਕੇ ਉੱਥੇ ਰਹਿ ਕੇ ਜਾਂਦੇ ਹਨ ਬਟ ਸਾਡੇ ਪਿੰਡ ਦੇ ਸਰਪੰਚ ਦੁਆਰਾ ਇੱਕ ਪਿੰਡ 'ਚ ਧਰਮਸ਼ਾਲਾ ਬਣਾਈ ਗਈ ਹੈ ਜਿੱਥੇ ਆ ਕੇ ਲੋਕ ਇੱਕ ਦੋ ਦਿਨ ਲਈ ਸਟੇਅ ਕਰ ਸਕਦੇ ਹਨ ਜਿਵੇਂ ਪਿੰਡਾਂ 'ਚ ਕਦੇ ਕਦੇ ਰਾਮਲੀਲਾ ਲੱਗਦੀ ਹੈ ਉਹ ਲੋਕ ਇਕੱਠੇ ਹੋ ਕੇ ਆਉਂਦੇ ਹਨ ਪਿੰਡ 'ਚ ਕੋਈ ਵੀ ਫੰਕਸ਼ਨ ਕਰਨ ਤਾਂ ਉਹ ਉੱਥੇ ਰਹਿਣ ਲਈ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ ਬਟ ਜਿਹੜੇ ਬਾਹਰੋਂ ਲੋਕ ਆਉਂਦੇ ਹਨ ਉਹਨਾਂ ਦੇ ਸੈ ਠਹਿਰਾਉਣ ਲਈ ਕੋਈ ਵੀ ਇੱਥੇ ਸਥਾਨ ਨਹੀਂ ਹੈਗਾ ਅਤੇ ਪਿ ਉਹ ਆ ਕੇ ਹੋਟਲਾਂ 'ਚ ਰਹਿ ਸਕਦੇ ਹਨ